ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਸਾਡੀ ਰੂਹ ਦੀ ਖੁਰਾਕ ਹੈ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਲੈ ਕੇ ਪੰਜਾਬੀ ਨਾਲ ਹੀ ਜੋੜ ਪੰਜਾਬੀ ਸਾਡੀ ਰੂਹ ਦੀ ਖੁਰਾਕ ਹੈ ਪੰਜਾਬੀ ਸਾਡਾ ਵਿਰਸਾ ਹੈ ਪੰਜਾਬੀ ਸਾਡਾ ਪਹਿਰਾਵਾ ਪੰਜਾਬੀ ਬਿਨਾਂ ਜਿਵੇਂ ਕਿ ਮਤਲਬ ਕੋਈ ਆਕਸੀਜਨ ਬਿਨਾਂ ਨਹੀਂ ਜੀ ਸਕਦਾ ਇਸ ਤਰ੍ਹਾਂ ਅਸੀਂ ਪੰਜਾਬੀ ਬਿਨਾਂ ਨਹੀਂ ਜੀ ਸਕਦੇ ਪੰਜਾਬੀ ਮਿੱਠੀ ਭਾਸ਼ਾ ਹੈ ਪੰਜਾਬੀ ਦੇ ਵਿੱਚ ਜਿੰਨੀ ਰਿਸਪੈਕਟ ਤੁਸੀਂ ਪੰਜਾਬੀ ਦੇ ਵਿੱਚ ਕਿਸੇ ਬੰਦੇ ਦੀ ਕਰ ਸਕਦੇ ਹੋ ਉੰਨੀ ਕਿਸੇ ਹੋਰ ਭਾਸ਼ਾ 'ਚ ਨਹੀਂ ਸਾਡੇ ਬੱਚੇ ਪੰਜਾਬੀ ਦੇ ਨਾਲ ਜੁੜੇ ਰਹਿਣਗੇ ਤਾਂ ਸਾਡੇ ਜਿਹੜਾ ਪੰਜਾਬ ਹੈ ਹਰਿਆ ਭਰਿਆ ਹੋਜੂਗਾ ਅਸੀਂ ਸਾਨੂੰ ਸਾਡੇ ਪੰਜਾਬ 'ਤੇ ਪੰਜਾਬੀ ਹੋਣ 'ਤੇ ਸਾਨੂੰ ਸਾਡੇ 'ਤੇ ਮਾਣ ਹੈ ਅਸੀਂ ਪੰਜਾਬੀ ਹਾਂ ਪੰਜਾਬ ਦੇ ਪੰਜਾਬੀ ਬੋਲਦੇ ਬਹੁਤ ਵੱਡੇ ਵੱਡੇ ਯੋਧੇ ਪੰਜਾਬ ਦੇ ਵਿੱਚੋਂ ਪੰਜਾਬੀ ਵਾਲੇ ਯੋਧੇ ਮਤਲਬ ਪੈਦਾ ਕੀਤੇ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ ਪੰਜਾਬੀ ਸੀਗੇ ਪੰਜਾਬੀ ਹੋਣ 'ਤੇ ਮਾਣ ਹੈ ਸਾਡੇ ਜਿੰਨੇ ਵੀ ਮਤਲਬ ਦੇਸ਼ ਦੀ ਆਜ਼ਾਦੀ ਵਿੱਚ ਸੰਘਰਸ਼ ਕੀਤਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿੰਨੇ ਵੀ ਮਤਲਬ ਸ਼ਹੀਦੀਆਂ ਦਿੱਤੀਆਂ ਸਾਡੇ ਪੰਜਾਬੀ ਸੀ ਪੰਜਾਬੀ ਬੋਲਦੇ ਸੀ ਇਸ ਕਰਕੇ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਨੂੰ ਬਚ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਪੰਜਾਬੀ ਨਾਲ ਹੀ ਜੋੜ ਕੇ ਰੱਖੀਏ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਬੱਚੇ ਅੱਜ ਕੱਲ੍ਹ ਪੰਜਾਬ ਨੂੰ ਛੱਡ ਕੇ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵੱਲ ਮੂੰਹ ਮਾਰ ਰਹੇ ਨੇ ਜੋ ਕਿ ਮਤਲਬ ਕੋਈ ਵਧੀਆ ਮਤਲਬ ਅੱਛੀ ਸੋਚ ਨਹੀਂ ਹੈ ਜਿਹੜੀ ਪੰਜਾਬੀ ਹੈ ਪੰਜਾਬੀ ਨਾਲ ਤੁਸੀਂ ਮਤਲਬ ਪੰਜਾਬੀ ਬੋਲੋਂਗੇ ਪੰਜਾਬੀ ਨਾਲ ਰਹੋਂਗੇ ਤਾਂ ਤੁਸੀਂ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖ ਸਕੋਂਗੇ ਪੰਜਾਬੀ ਸਾਡੀ ਰੂਹ ਦੀ ਖੁਰਾਕ ਹੈ ਪੰਜਾਬੀ ਬਹੁਤ ਹੀ ਮਿੱਠ ਬੋਲੜੀ ਮਤਲਬ ਜਿਹੜੀ ਸਾਡੀ ਭਾਸ਼ਾ ਪੰਜਾਬੀ ਹੈ ਇੱਕ ਪਾਸੇ ਤੁਸੀਂ ਪੰਜਾਬੀ ਬੋਲੋ ਇੱਕ ਪਾਸੇ ਤੁਸੀਂ ਕੁਛ ਹੋਰ ਭਾਸ਼ਾ ਬੋਲੋ ਜਦੋਂ ਕਿ ਤੁਹਾਨੂੰ ਪੰਜਾਬੀ ਬੋਲਣ ਦੇ ਵਿੱਚ ਇੱਕ ਬੱਚ ਕੋਈ ਵੀ ਬੱਚਾ ਹੈ ਪੰਜਾਬੀ ਦੇ ਵਿੱਚ ਇੰਗਲਿਸ਼ ਦੇ ਵਿੱਚ ਚਾਚੇ ਨੂੰ ਵੀ ਮਤਲਬ ਅੰਕਲ ਤਾਏ ਨੂੰ ਵੀ ਅੰਕਲ ਮਤਲਬ ਮਾਮੇ ਨੂੰ ਵੀ ਅੰਕਲ ਪੰਜਾਬੀ ਦੇ ਵਿੱਚ ਵ ਵੱਖ ਵੱਖ ਜਿਹੜੇ ਉਹ ਨੇ ਜਿਵੇਂ ਪੰਜਾਬੀ 'ਚ ਮਾਮੇ ਨੂੰ ਅਸੀਂ ਮਾਮਾ ਕਹਿੰਦੇ ਹਾਂ ਚਾਚੇ ਨੂੰ ਅਸੀਂ ਚਾਚਾ ਕਹਿੰਦੇ ਹਾਂ ਸਾਡੇ ਬੱਚੇ ਮਤਲਬ ਜਦੋਂ ਤੋਤਲੀ ਅਵਾਜ਼ ਨਾਲ ਪੰਜਾਬੀ 'ਚ ਸਾਨੂੰ ਪਾਪਾ ਜਾਂ ਸਾਨੂੰ ਮੰਮੀ ਬੀਜੀ ਕਹਿੰਦੇ ਨੇ ਜਾਂ ਸਾਨੂੰ ਮਤਲਬ ਵੀ ਆਪਣਾ ਚਾਚਾ ਜੀ ਕਹਿੰਦੇ ਨੇ ਤਾਂ ਸਾਨੂੰ ਬਹੁਤ ਫਖ਼ਰ ਮਹਿਸੂਸ ਹੁੰਦਾ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਹੀ ਸਿਖਾਉਣਾ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਕੂਲਾਂ 'ਚ ਪੜ੍ਹਾ ਕੇ ਪੰਜਾਬੀ ਨਾਲ ਹੀ ਜੋੜਨਾ ਚਾਹੁੰਦੇ ਹਾਂ ਤਾਂ ਕਿ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿਣ ਸਾਨੂੰ ਮੈਂ ਲਾਸਟ 'ਤੇ ਇੱਕ ਵਾਰ ਫਿਰ ਕਹਿ ਰਿਹਾ ਵੀ ਸਾਨੂੰ ਪੰਜਾਬੀ ਹੋਣ ਦਾ ਸੱਚ ਮੁੱਚ ਮਾਣ ਹੈ ਸੂਰਵੀਰ ਯੋਧੇ ਜੋ ਵੀ ਮਤਲਬ ਅੱਜ ਕੱਲ੍ਹ ਜਿੰਨੇ ਵੀ ਮਤਲਬ ਗੁਰ ਪੀਰ ਹੋਏ ਨੇ ਸਭ ਮਤਲਬ ਪੰਜਾਬ 'ਚ ਹੋਏ ਨੇ ਪੰਜਾਬੀ ਬੋਲਦੇ ਹੋਏ ਨੇ